ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਲਿੰਗ ਅਸਮਾਨਤਾ ਅਤੇ ਵਿਤਕਰੇ ਦੇ ਮੁੱਦੇ ਨੂੰ ਹੱਲ ਕਰਨ ਲਈ ਨੀਤੀਆਂ ਬਣਾਈਆਂ ਗਈਆਂ ਹਨ ਪਹਿਲ ਕੀਤੀਆਂ ਗਈਆਂ ਹਨ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਲਿੰਗ ਅਸਮਾਨਤਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਕੁੜੀਆਂ ਮੁੰਡੇ ਬਰਾਬਰ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵੱਧ ਰਹੇ ਹਨ ਮੁੰਡਾ ਕੁੜੀ ਕਿਸੇ ਵੀ ਪੱਖੋਂ ਘੱਟ ਨਹੀਂ ਹੈ ਅੱਜ ਕੱਲ੍ਹ ਅਸੀਂ ਕਿਸੇ ਵੀ ਦਫਤਰ ਵਿੱਚ ਜਾਈਏ ਤਾਂ ਜਿੱਥੇ ਮੁੰਡੇ ਨੌਕਰੀਆਂ ਕਰਦੇ ਉਨੀਆਂ ਹੀ ਕੁੜੀਆਂ ਨੌਕਰੀ ਕਰਦੀਆਂ ਹਨ ਕੁੜੀਆਂ ਮੁੰਡਿਆਂ ਨਾਲੋਂ ਘੱਟ ਪਿੱਛੇ ਨਹੀਂ ਹਨ ਪੜ੍ਹਾਈ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਅੱਜ ਕੁੜੀਆਂ ਹਰ ਖੇਤਰ ਵਿੱਚ ਅੱਗੇ ਵਧੀਆਂ ਹੋਈਆਂ ਹਨ ਚਾਹੇ ਤੁਸੀਂ ਪਾਇਲਟ ਵਿੱਚ ਦੇਖ ਪਾਇਲਟ ਦੇਖ ਲਓ ਕੁੜੀਆਂ ਹਨ ਮੈਟਰੋ ਦੇ ਡਰਾਈਵਰ ਦੇਖ ਲਓ ਕੁੜੀਆਂ ਵੀ ਹਨ ਭਾਵੇਂ ਤੁਸੀਂ ਵੱਡੇ ਵੱਡੇ ਬਿਜ਼ਨਸਮੈਨ ਦੇਖ ਲਓ ਔਰਤਾਂ ਹਨ ਇਹਨਾਂ ਦੀਆਂ ਬਹੁਤ ਇਗਜਾਮਪਲਾਂ ਵੀ ਹਨ ਜਿਵੇਂ ਕਿ ਨੀਤਾ ਅੰਬਾਨੀ ਬਹੁਤ ਵੱਡੀ ਬਿਜ਼ਨਸਮੈਨ ਹੈ ਪਾਇਲਟਸ ਦੇਖ ਲਓ ਐਸਟਰੋਨਰਸ ਦੇਖ ਲਓ ਇਸੇ ਤਰ੍ਹਾਂ ਮੈਟਰੋ ਦੇ ਪਾਇਲਟਸ ਦੇਖ ਲਓ ਇਸੇ ਤਰ੍ਹਾਂ ਤੁਸੀਂ ਹੋਰ ਵੀ ਕਈ ਜਗ੍ਹਾ 'ਤੇ ਦੇਖੋਗੇ ਕਿ ਕੁੜੀਆਂ ਮੁੰਡੇ ਕਿਸੇ ਪਿੱਛੇ ਨਹੀਂ ਸਕੂਲਾਂ ਦੇ ਵਿੱਚ ਦੇਖੋਗੇ ਤਾਂ ਕੁੜੀਆਂ ਜ਼ਿਆਦਾ ਹੋਣਗੀਆਂ ਜਿਹਨਾਂ ਦੇ ਨੰਬਰ ਜ਼ਿਆਦਾ ਹੁੰਦੇ ਹੋਣਗੇ ਪੜ੍ਹਨ ਵਿੱਚ ਵੀ ਉਹ ਅੱਗੇ ਹੋਣਗੀਆਂ ਸੋ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਪੜ੍ਹਾਈਆਂ ਵਿੱਚ ਵੀ ਸਮਝਾਇਆ ਜਾ ਰਿਹਾ ਹੈ ਸਕੂਲਾਂ ਵਿੱਚ ਸਮਝਾਇਆ ਜਾ ਰਿਹਾ ਹੈ ਬਾਹਰ ਮੀਟਿੰਗਸ ਹੁੰਦੀਆਂ ਨੇ ਬਾਹਰ ਸਭਾਵਾਂ ਹੁੰਦੀਆਂ ਨੇ ਜਿੱਥੇ ਕਿ ਇਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਕੁੜੀ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਕੁੜੀਆਂ ਨੂੰ ਹੋਰ ਵੱਧ ਤੋਂ ਵੱਧ ਦਿੱਤੀਆਂ ਜਾਂਦੀਆਂ ਹਨ ਪੋਸੀਬਿਲਿਟੀਸ ਤਾਂ ਕਿ ਉਹਨਾਂ ਦਾ ਵੀ ਫਿਊਚਰ ਬਰਾਈਟ ਹੋ ਸਕੇ ਧੰਨਵਾਦ